ਸਾਡੇ ਖੇਤਰ ਵਿੱਚ ਦਸਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਦੀਆਂ ਵਿਦਿਅਕ ਤਰਜੀਹਾਂ ਨੋਨ ਮੈਡੀਕਲ ਦਾ ਸਬਜੈਕਟ ਹੁੰਦਾ ਹੈ ਇਸ ਵਿੱਚ ਤੁਹਾਨੂੰ ਸਾਇੰਸ ਦੇ ਨਾਲ ਨਾਲ ਮੈਥਸ ਲੈਣਾ ਪੈਂਦਾ ਹੈ ਗਣਿਤ ਜਿਸ ਦਾ ਅੱਗੇ ਬਹੁਤ ਵੱਧ ਕੇ ਇਸਤੇਮਾਲ ਹੁੰਦਾ ਹੈ ਕਿਉਂਕਿ ਇਹ ਮੂਲ ਰੂਪ ਵਿੱਚ ਇੰਜੀਨੀਅਰਿੰਗ ਲਈ ਹੀ ਹੁੰਦਾ ਹੈ ਇਸ ਦੇ ਨਾਲ ਤੁਸੀਂ ਹੋਰ ਵੀ ਕੰਮ ਕਰ ਸਕਦੇ ਹੋ ਪਰ ਮੂਲ ਰੂਪ ਇੰਜੀਨੀਅਰਿੰਗ ਦਾ ਹੁੰਦਾ ਹੈ ਅਤੇ ਨੋਨ ਮੈਡੀਕਲ ਦਾ ਵਿਸ਼ਾ ਲੈ ਕੇ ਹੀ ਵਿਦਿਆਰਥੀ ਸਾਡੇ ਖੇਤਰ ਵਿੱਚ ਆ ਸਕਦੇ ਹਨ ਸਾਡਾ ਖੇਤਰ ਹੈ ਸੋਫਟਵੇਅਰ ਇੰਜੀਨੀਅਰਿੰਗ ਜਿਸ ਜਿਸ ਵਿੱਚ ਅਸੀਂ ਦਸਵੀਂ ਤੋਂ ਬਾਅਦ ਨੋਨ ਮੈਡੀਕਲ ਨੋਨ ਮੈਡੀਕਲ ਦੇ ਨਾਲ ਨਾਲ ਕੰਪਿਊਟਰ ਦੀ ਪੜ੍ਹਾਈ ਵੀ ਸ਼ੁਰੂ ਕਰ ਸਕਦੇ ਹਾਂ ਪਰ ਇਸ ਤੋਂ ਇਲਾਵਾ ਜਿਹੜਾ ਮੂਲ ਜ਼ਰੂਰੀ ਹੈ ਉਹ ਹੈ ਨੋਨ ਮੈਡੀਕਲ ਦਾ ਵਿਸ਼ਾ